ਸਤਿ ਸ਼੍ਰੀ ਅਕਾਲ ਤੁਸੀਂ ਬੇਅੰਤ ਕੋਲੇਜ ਤੋਂ ਬੋਲਦੇ ਹਾਂਜੀ ਸਰ ਮੈਂ ਪੁੱਛਣਾ ਸੀਗਾ ਕਿ ਮੇਰੀ ਛੋਟੀ ਭੈਣ ਹੈ ਜਿਹੜੀ ਉਨ੍ਹਾਂ ਨੇ ਬਾਰਵੀਂ ਹੁਣ ਪੂਰੀ ਕੀਤੀ ਹੈ ਅਤੇ ਅਸੀਂ ਉੱਥੇ ਬੇਅੰਤ ਕੋਲੇਜ 'ਚ ਅਡਮੀਸ਼ਨ ਦਿਲਾਣੀ ਸੀ ਉਹਨੂੰ ਉਹਨੇ ਨੋਨ ਮੈਡੀਕਲ ਕੀਤਾ ਆ ਹਾਂਜੀ ਅਤੇ ਤੁਸੀਂ ਮੈਨੂੰ ਸਮਝਾ ਸਕਦੇ ਹੋ ਕਿ ਕਿਹੜੇ ਕਿਹੜੇ ਕੋਰਸ ਅੱਗੇ ਵਧੀਆ ਨੇ ਕਿਸ 'ਚ ਜ਼ਿਆਦਾ ਸਕੋਪ ਹੈ ਅਤੇ ਫੀ ਸਟਰਕਚਰ ਕੀ ਹੈ ਉਹਦਾ

ਹਾਂਜੀ ਹਾਂਜੀ ਅਸੀਂ ਹੁੰਦੇ ਤਾਂ ਜਨਰਲ ਦੇ ਹਾਂ ਪਰ ਉਹਨੇ ਨੰਬਰ ਚੰਗੇ ਲਏ ਆ ਬਾਰਵੀਂ 'ਚੋਂ ਪਚਾਨਵੇਂ ਤੋਂ ਉਤਾਂਹ ਲਏ ਹੈ ਅਤੇ ਕੋਈ ਹਾਂਜੀ ਸਿੱਖ ਮਨਿਓਰਿਟੀ ਦੀ ਲੱਗਦੀ ਹੈ ਸਕੋਲਰਸ਼ਿਪ ਅੱਛਾ ਅੱਛਾ ਅਤੇ ਕਦੋਂ ਤੱਕ ਅਡਮੀਸ਼ਨਾਂ ਖੁੱਲ੍ਹੀਆਂ ਹੈ ਉੱਥੇ ਅੱਛਾ ਕੋਲੇਜ ਜਾ ਕੇ ਨਹੀਂ ਹੋਏਗੀ

ਅੱਛਾ ਅੱਛਾ ਅਤੇ ਸਰ ਜਿਹੜੀ ਆ ਬੀ ਟੈਕ ਹੈ ਅਤੇ ਇਹ ਸੀ ਐੱਸ ਸੀ 'ਚ ਅਵੈਲਏਵਲ ਹੈ ਉੱਥੇ ਹਾਂਜੀ ਅੱਛਾ ਠੀਕ ਹੈ ਅਤੇ ਅਸੀਂ

ਠੀਕ ਹੈ ਠੀਕ ਹੈ ਫਿਰ ਅਸੀਂ ਕੱਲ੍ਹ ਪਰਸੋਂ ਤੱਕ ਆਉਂਦੇ ਹਾਂ ਅਤੇ ਫਿਰ ਵਿਜਿਟ ਕਰ ਕੇ ਦੇਖਦੇ ਹਾਂ ਉੱਥੇ ਠੀਕ ਠੀਕ ਅਤੇ ਉਹ ਫੀ ਸਟਰਕਚਰ ਜਿਹੜਾ ਉਹ ਠੀਕ ਠਾਕ ਹੀ ਹੈ ਮਤਲਬ ਕਿ ਸਾਡੀ ਲੋਅ ਕਾਸਟ ਹੈ ਨਾ ਥੋੜ੍ਹੀ ਇਨਕਮ ਸੋਰਸ ਠੀਕ ਹੈ ਠੀਕ ਹੈ ਚਲੋ ਥੈਂਕਿਊ ਸਰ ਫਿਰ